ਹਾਂਜੀ ਸਿੱਧੂ ਰੈਸਟੋਰੈਂਟ ਤੋਂ ਬੋਲਦੇ ਹੋ ਜੀ ਹਾਂਜੀ ਅਸੀਂ ਬੜੀ ਹਵੇਲੀ ਤੋਂ ਬੋਲਦੇ ਹਾਂ ਜੀ ਅਸੀਂ ਖਾਣੇ ਵਾਸਤੇ ਟੇਬਲ ਬੁੱਕ ਕਰਵਾਉਣੀ ਸੀ ਜੀ ਹਾਂਜੀ ਅਸੀਂ ਸਵੇਰ ਨੂੰ ਆਉਣਾ ਜੀ ਖਾਣੇ 'ਤੇ ਅਤੇ ਪੰਦਰਾਂ ਵੀਹ ਜਾਣੇ ਹੋ ਜਾਣਗੇ ਸਾਡੇ ਹਾਂਜੀ ਦੋ ਟੇਬਲ ਬੁੱਕ ਕਰਾ ਦਿਓ ਜੀ ਅਤੇ ਖਾਣਾ ਵੈਸ਼ਨੂੰ ਢੰਗ ਨਾ ਨਾਲ ਹੋਵੇ ਤਿਆਰ ਕੀਤਾ ਹੋਇਆ ਕਿਉਂਕਿ ਸਾਰਿਆ ਨੇ ਅਸੀਂ ਅੰਮ੍ਰਿਤ ਛੱਕਿਆ ਹੋਇਆ ਇਸ ਕਰਕੇ ਵਧੀਆ ਢੰਗ ਨਾਲ਼ ਤਰੀਕੇ ਨਾਲ਼ ਵਧੀਆ ਖਾਣਾ ਹੋਵੇ ਜੀ ਹਾਂਜੀ ਸਾਨੂੰ ਟਾਈਮ ਵੀ ਦੱਸ ਦਿਓ ਜੀ ਅਤੇ ਪੈਸੇ ਦੱਸ ਦਿਓ ਜੀ ਕਿੰਨੇ ਹੋਏ ਇਹਦੇ ਹਾਂਜੀ ਠੀਕ ਹੈ ਠੀਕ ਹੈ ਜੀ ਓਕੇ ਓਕੇ ਜੀ